ਇੱਕ ਸੌ ਉਣੰਜਾ ਦੋ ਹਜ਼ਾਰ ਪਚਾਸੀ ਦੋ ਲੱਖ ਪੰਦਰਾਂ ਹਜ਼ਾਰ ਪੰਜ ਸੌ ਤਰਤਾਲੀ ਚਾਰ ਲੱਖ ਪੰਨਤਾਲੀ ਹਜ਼ਾਰ ਦੋ ਸੌ ਵੀਹ ਸੱਤ ਲੱਖ ਅਠਵੰਜਾ ਹਜ਼ਾਰ ਚਾਰ ਸੌ ਚਾਲੀ